ਮੈਂ ਇੱਕ ਮਹੱਤਵਪੂਰਨ ਵਪਾਰਕ ਮੀਟਿੰਗ ਵਿੱਚ ਹਿੱਸਾ ਲੈਣ ਲਈ ਤਿਆਰੀ ਕਰ ਰਹੀ ਹਾਂ ਜਿਸ ਲਈ ਮੈਨੂੰ ਸਫ਼ਰ ਕਰਨ ਦੀ ਲੋੜ ਪਵੇਗੀ ਇਸ ਸਫ਼ਰ ਦੌਰਾਨ ਮੈਨੂੰ ਕੁਝ ਖਰਚਿਆਂ ਦੀ ਗਿਣਤੀ ਵੀ ਕਰਨੀ ਪਵੇਗੀ ਖ਼ਾਸ ਕਰਕੇ ਟਰੇਨ ਦੀ ਯਾਤਰਾ ਦੇ ਕਿਰਾਏ ਦੀ ਮੇਰੇ ਲਈ ਇਹ ਮੀਟਿੰਗ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਮੇਰੇ ਕੰਮ ਨਾਲ ਸੰਬੰਧਿਤ ਹੈ ਅਤੇ ਇਸਦਾ ਮਤਲਬ ਮੇਰੇ ਕਰੀਅਰ ਵਿੱਚ ਇਕ ਅਹਿਮ ਭੂਮਿਕਾ ਨਿਭਾਉਣ ਵਾਲਾ ਹੈ ਮੈਂ ਚਾਹੁੰਦੀ ਹਾਂ ਕਿ ਮੇਰੇ ਸਾਰੇ ਖ਼ਰਚਿਆ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਮੈਨੂੰ ਟਰੇਨ ਦੇ ਕਿਰਾਏ ਦਾ ਅੰਦਾਜ਼ਾ ਹੋ ਜਾਵੇ ਤਾਂ ਜੋ ਮੈਂ ਸਾਰੇ ਖਰਚਿਆਂ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਯੋਜਨਾ ਬਣਾ ਸਕਾਂ ਤੁਸੀਂ ਹਮੇਸ਼ਾ ਮੈਨੂੰ ਸਹੀ ਸਲਾਹ ਦਿੰਦੇ ਹੋ ਇਸ ਲਈ ਮੈਂ ਸੋਚਿਆ ਕਿ ਮੈਨੂੰ ਤੁਹਾਡੀ ਮਦਦ ਦੀ ਲੋੜ ਪਵੇਗੀ ਕੀ ਤੁਸੀਂ ਮੈਨੂੰ ਇਹ ਪਤਾ ਕਰਨ ਵਿੱਚ ਮਦਦ ਕਰ ਸਕਦੇ ਹੋ ਕਿ ਟਰੇਨ ਦੇ ਕਿਰਾਏ ਦਾ ਅੰਦਾਜ਼ਾ ਕਿੰਨਾ ਹੋ ਸਕਦਾ ਹੈ ਤਾਂ ਜੋ ਮੈਂ ਉਸ ਤਰੀਕੇ ਦੇ ਨਾਲ ਆਪਣੀ ਯਾਤਰਾ ਦੀ ਯੋਜਨਾ ਕਰ ਸਕਾਂ ਮੈਂ ਕਿਸ ਸਟੇਸ਼ਨ ਤੋਂ ਕਿਸ ਸਟੇਸ਼ਨ ਤੱਕ ਯਾਤਰਾ ਕਰਨੀ ਹੈ ਅਤੇ ਟਰੇਨ ਦੀ ਕਲਾਸ ਦਾ ਵੀ ਧਿਆਨ ਰੱਖਣਾ ਪਵੇਗਾ ਜਿਵੇਂ ਕਿ ਸਲੀਪਰ ਏ ਸੀ ਜਾਂ ਸਧਾਰਨ ਕਲਾਸ ਇਹ ਜਾਣਕਾਰੀ ਮਿਲਣ ਨਾਲ ਮੈਨੂੰ ਮੇਰੇ ਯਾਤਰਾ ਖਰਚੇ ਦਾ ਸਹੀ ਅੰਦਾਜ਼ਾ ਲਗਾਉਣ ਵਿੱਚ ਮਦਦ ਮਿਲੇਗੀ ਅਤੇ ਮੈਂ ਆਪਣੀ ਯਾਤਰਾ ਲਈ ਵਧੇਰੇ ਤਿਆਰੀ ਵੀ ਕਰ ਸਕਾਂਗੀ ਇਸ ਕਰਕੇ ਤੁਸੀਂ ਮੈਨੂੰ ਪੂਰੀ ਜਾਣਕਾਰੀ ਆਪਣੀ ਰਿਸਰਚ ਦੇ ਨਾਲ ਕਰਕੇ ਦੱਸ ਦੇਣਾ ਤਾਂ ਜੋ ਮੈਂ ਆਪਣੀ ਟਰੇਨ ਦੀ ਬੁਕਿੰਗ ਉਸ ਦੇ ਹਿਸਾਬ ਦੇ ਨਾਲ ਕਰ ਸਕਾਂ ਅਤੇ ਬਜਟ ਵੀ ਬਣਾ ਸਕਾਂ ਕਿਰਪਾ ਕਰਕੇ ਜੇ ਤੁਸੀਂ ਇਹ ਪਤਾ ਕਰ ਸਕਦੇ ਹੋ ਤਾਂ ਜੋ ਮੈਂ ਤੁਹਾਡਾ ਬਹੁਤ ਧੰਨਵਾਦੀ ਰਹਾਂਗੀ ਇਸ ਲਈ ਸਾਡੀ ਯੋਜਨਾ ਬਣਾਉਣ ਵਿੱਚ ਸਹਾ ਬਹੁਤ ਸਹਾਇਕ ਹੋਵੇਗਾ ਅਤੇ ਇਸ ਨਾਲ ਮੈਨੂੰ ਆਉਣ ਵਾਲੇ ਦਿਨਾਂ ਵਿੱਚ ਹੋਰ ਚੀਜ਼ਾਂ ਦੇ ਪ੍ਰਬੰਧ ਕਰਨ ਵਿੱਚ ਸਹੂਲਤਾਂ ਮਿਲੇਗੀ ਕ੍ਰਿਪਾ ਕਰਕੇ ਮੇਰੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਮੈਂ ਚਾਹੁੰਦੀ ਹਾਂ ਤੁਹਾਡੀ ਸਲਾਹ ਤੋਂ ਬਿਨਾਂ ਮੈਂ ਟਰੇਨ ਵਿੱਚ ਸਫ਼ਰ ਨਾ ਕਰਾਂ ਤੁਸੀਂ ਦੱਸੀ ਗਈ ਸੀਟ ਸਲੀਪਰ ਏ ਸੀ ਜਾਂ ਸਧਾਰਨ ਕਲਾਸ ਦੇ ਦੁਆਰਾ ਕੀਤੇ ਜਾਣ ਵਾਲੀ ਸਫ਼ਰ ਵਿੱਚ ਮੈਨੂੰ ਬਹੁਤ ਮਦਦ ਮਿਲੇਗੀ